ਜੀ ਹਾਂ ਸਾਡੇ ਖੇਤਰ ਵਿੱਚ ਗਾਇਕੀ ਨਾਲ ਸੰਬੰਧਿਤ ਪ੍ਰੋਗਰਾਮ ਹੁੰਦੇ ਰਹਿੰਦੇ ਹਨ ਅਜੇ ਤੱਕ ਸਾਡੇ ਇਲਾਕੇ ਵਿੱਚ ਚਾਰ ਗਾਇਕੀ ਪ੍ਰੋਗਰਾਮ ਹੋਏ ਸਨ ਜਿਹਨਾਂ ਵਿੱਚ ਕਰਨ ਔਜਲਾ ਦਿਲਜੀਤ ਦੋਸਾਂਝ ਨਿਰਵੈਰ ਪੰਨੂ ਅਤੇ ਸਤਿੰਦਰ ਸਰਤਾਜ ਨੂੰ ਬੁਲਾਇਆ ਗਿਆ ਪਰ ਮੈਨੂੰ ਇਹਨਾਂ ਚਾਰ ਗਾਇਕੀ ਪ੍ਰੋਗਰਾਮਾਂ ਵਿੱਚ ਵਿੱਚੋਂ ਸਤਿੰਦਰ ਸਰਤਾਜ ਦੇ ਪ੍ਰੋਗਰਾਮ 'ਤੇ ਜਾਣ ਦਾ ਮੌਕਾ ਮਿਲਿਆ ਸਤਿੰਦਰ ਸਰਤਾਜ ਦੇ ਗਾਇਕੀ ਪ੍ਰੋਗਰਾਮ ਦਾ ਪਤਾ ਮੈਨੂੰ ਆਪਣੀ ਸਹੇਲੀ ਦੁਆਰਾ ਲੱਗਿਆ ਅਸੀਂ ਮਹੀਨਾ ਪਹਿਲੇ ਹੀ ਸਤਿੰਦਰ ਸਰਤਾਜ ਦੇ ਗਾਇਕੀ ਪ੍ਰੋਗਰਾਮ ਦੀਆਂ ਟਿਕਟਾਂ ਵੀ ਆਈ ਪੀ ਟਿਕਟਾਂ ਬੁੱਕ ਕਰਵਾ ਦਿੱਤੀਆਂ ਸੀ ਵੀ ਆਈ ਪੀ ਪਾਸ ਦੋ ਹਜ਼ਾਰ ਦਾ ਸੀ ਅਤੇ ਅਸੀਂ ਜਿਸ ਦਿਨ ਗਾਇਕੀ ਪ੍ਰੋਗਰਾਮ ਸੀ ਅਸੀਂ ਉਸ ਦਿਨ ਅੱਠ ਵਜੇ ਜਾ ਕੇ ਆਪਣੀਆਂ ਸੀਟਾਂ ਬੁੱਕ ਕਰ ਲਿੱਤੀਆਂ ਸੀ ਵੀ ਆਈ ਪੀ ਪਾਸ ਵਾਲਿਆਂ ਦਾ ਅਰੇਂਜਮੈਂਟ ਬਹੁਤ ਹੀ ਵਧੀਆ ਸੀ ਅਤੇ ਉਹਨਾਂ ਨੂੰ ਸਭ ਤੋਂ ਅੱਗੇ ਬੈਠਣ ਦਾ ਮੌਕਾ ਮਿਲਿਆ ਅਤੇ ਜਿਹੜੇ ਵੀ ਆਈ ਪੀ ਪਾਸ ਵਾਲੇ ਸਨ ਉਹਨਾਂ ਨੂੰ ਖਾਣ ਪੀਣ ਦਾ ਇੰਤਜ਼ਾਮ ਬਹੁਤ ਵਧੀਆ ਮਿਲਿਆ ਉਹਨਾਂ ਨੇ ਬਹੁਤ ਹੀ ਆਨੰਦ ਕੀਤਾ ਅਤੇ ਸਤਿੰਦਰ ਸਰਤਾਜ ਨੇ ਬਹੁਤ ਹੀ ਵਧੀਆ ਵਧੀਆ ਗਾਣੇ ਗਾਏ ਅਤੇ ਸਤਿੰਦਰ ਸਰਤਾਜ ਨੇ ਕੁੜੀਆਂ ਨੂੰ ਸਭ ਤੋਂ ਅੱਗੇ ਬੁਲਾਇਆ ਅਤੇ ਉਹਨਾਂ ਤੋਂ ਭੰਗੜਾ ਕਰਵਾਇਆ ਅਤੇ ਜਿਹਦੇ ਵਿੱਚ ਸਤਿੰਦਰ ਸਰਤਾਜ ਨੂੰ ਮੇਰਾ ਭੰਗੜਾ ਬਹੁਤ ਹੀ ਵਧੀਆ ਲੱਗਿਆ ਅਤੇ ਉਹਨਾਂ ਨੇ ਮੈਨੂੰ ਸਟੇਜ 'ਤੇ ਬੁਲਾਇਆ ਅਤੇ ਆਪਣੇ ਨਾਲ ਫੋਟੋ ਖਿੱਚਣ ਦਾ ਮੌਕਾ ਦਿੱਤਾ ਅਤੇ ਉਹਨਾਂ ਨੇ ਮੈਨੂੰ ਆਪਣਾ ਹਸਤਾਖਰ ਵੀ ਦਿੱਤੇ ਅਤੇ ਉਹਨਾਂ ਨੇ ਬਹੁਤ ਹੀ ਭੰਗੜਾ ਕੀਤਾ ਮੇਰੇ ਨਾਲ ਅਤੇ ਇਸ ਪ੍ਰੋਗਰਾਮ ਦਾ ਯੂਟੀਊਬ 'ਤੇ ਵੀ ਲਾਈਵ ਆਇਆ ਸੀ ਜਿਸ ਕਰਕੇ ਲੋਕਾਂ ਨੇ ਘਰ ਬੈਠ ਕੇ ਹੀ ਸੁਰਿੰਦਰ ਸਰਤਾਜ ਦਾ ਲਾਈਵ ਪ੍ਰੋਗਰਾਮ ਦੇਖਿਆ ਅਤੇ ਸਤਿੰਦਰ ਸਰਤਾਜ ਦੇ ਜਿਹੜੇ ਗਾਣੇ ਹਨ ਉਹ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਹੋਏ ਹਨ ਜਿਸ ਕਰਕੇ ਸਭ ਲੋਕ ਸਤਿੰਦਰ ਸਰਤਾਜ ਦੇ ਗਾਣਿਆਂ ਨੂੰ ਬਹੁਤ ਹੀ ਪਸੰਦ ਕਰਦੇ ਹਨ ਅਤੇ ਸਤਿੰਦਰ ਸਰਤਾਜ ਦੇ ਮੈਨੂੰ ਗਾਇਕੀ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਅਤੇ ਮੈਂ ਪਹਿਲੀ ਵਾਰ ਉਹਨਾਂ ਦੇ ਪ੍ਰੋਗਰਾਮ 'ਤੇ ਗਈ ਸੀ ਤਾਂ ਮੇਰਾ ਬਹੁਤ ਹੀ ਵਧੀਆ ਪ੍ਰੋਗਰਾਮ ਗਿਆ ਧੰਨਵਾਦ